ਮੇਰਾ ਨਾਮ ਮੋਨਿਕਾ ਹੈ ਮੈਂ ਤੁਹਾਨੂੰ ਅੱਜ ਆਸਣ ਬਾਰੇ ਕੁਝ ਗੱਲਾਂ ਦੱਸਣਾ ਚਾਹੁੰਦੀ ਹੈ ਜੋ ਕਿ ਸਾਡੇ ਸਰੀਰ ਦੀ ਲਚਕਤਾ ਵਧਾਉਣ ਵਿੱਚ ਮੱਦਦ ਕਰਦੀ ਹੈ ਜਿਵੇਂ ਕਿ ਸਾਡੇ ਸਰੀਰ ਨੂੰ ਸਭ ਤੋਂ ਪਹਿਲਾਂ ਸਵੇਰੇ ਜਲਦੀ ਉੱਠਣ ਦੀ ਆਦਤ ਪਾ ਲੈਣੀ ਚਾਹੀਦੀ ਹੈ ਇਸ ਨਾਲ ਸਾਡਾ ਸਰੀਰ ਚੰਗੀ ਤਰ੍ਹਾਂ ਕੰਮ ਕਰਨ ਵਿੱਚ ਮੱਦਦ ਵੀ ਕਰਦਾ ਹੈ ਜਿਵੇਂ ਕਿ ਸ ਸਵੇਰੇ ਜਲਦੀ ਉੱਠਣ ਤੋਂ ਪਹਿਲਾਂ ਸਾਨੂੰ ਗਰਮ ਪਾਣੀ ਦਾ ਗਲਾਸ ਪੀਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਸਾਨੂੰ ਦਸ ਪੰਦਰਾਂ ਮਿੰਟ ਦੌੜ ਲਗਾਣੀ ਵੀ ਚਾਹੀਦੀ ਹੈ ਅਤੇ ਨਾਲ ਨਾਲ ਹੀ ਘੰ ਘੰਟਾ ਜਾਂ ਅੱਧਾ ਘੰਟਾ ਸਾਨੂੰ ਕਸਰਤ ਵੀ ਕਰਨੀ ਚਾਹੀਦੀ ਹੈ ਇਸ ਨਾਲ ਸਾਡੇ ਸਰੀਰ ਦੀ ਥਕਾਵਟ ਵੀ ਦੂਰ ਹੋ ਜਾਂਦੀ ਹੈ ਸਾਡਾ ਮਨ ਸ਼ਾਂਤ ਵੀ ਰਹਿੰਦਾ ਹੈ ਅਤੇ ਅਸੀਂ ਕੁਝ ਹੋਰ ਗੱਲਾਂ ਵੀ ਤੁਹਾਨੂੰ ਇਸ ਬਾਰੇ ਦੱਸਣਾ ਚਾਹੁੰਦੀ ਹੈ ਜੋ ਕਿ ਸਾਡੇ ਸਰੀਰ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ ਇਸਦੀਆਂ ਬਹੁਤ ਸਾਰੀਆਂ ਉਹ ਹੈ ਮਤਲਬ ਬਹੁਤ ਸਾਰੀਆਂ ਇਸ ਦੀਆਂ ਯੋਗਤਾ ਹੈ ਜੋ ਕਿ ਸਾਡੇ ਸਰੀਰ ਨੂੰ ਉਸ ਨਾ ਕਰਨ ਨਾਲ ਉਹ ਗੱਲਾਂ ਕਰਨ ਨਾਲ ਸਾਡੇ ਸਰੀਰ ਵਿੱਚ ਚੁਸਤੀ ਤੰਦਰੁਸਤੀ ਵੀ ਪੈਦਾ ਹੁੰਦੀ ਹੈ